ਜਿਵੇਂ ਕਿ ਦੇਖਿਆ ਜਾਵੇ ਮੈਂ ਬਹੁਤ ਸਾਰੇ ਸਿੱਕੇ ਪੱਥਰ ਸੰਭਾਲ ਕੇ ਰੱਖੇ ਹੋਏ ਹਨ ਪਰ ਪਹਿਲੇ ਸਮੇਂ ਵਿੱਚ ਮੇਰੇ ਦਾਦਾ ਜੀ ਦੇ ਸਮੇਂ ਸਤ ਸਤਲੁਜ ਦਰਿਆਂ ਅਤੇ ਉੱਨੀ ਸੌ ਅਠਾਸੀ ਵਿੱਚ ਸਾਡੇ ਪਿੰਡ ਵਿੱਚ ਹੜ੍ਹ ਹੜ੍ਹ ਆ ਗਿਆ ਸੀ ਜਿਸ ਕਰਕੇ ਕਈ ਚੱਟਾਨਾਂ ਦੇ ਪੱਥਰ ਰੁੜ੍ਹ ਕੇ ਆਏ ਹਨ ਹੜ੍ਹ ਕੇ ਆਏ ਹਨ ਅਤੇ ਕਈ ਰੰਗ ਬਰੰਗੇ ਪੱਥਰ ਹਨ ਹੁਣ ਉਹ ਮੈਂ ਸ਼ੋਅ ਕੇਸ਼ ਵਿੱਚ ਲਗਾਏ ਹੋਏ ਹਨ ਜੋ ਮੈਨੂੰ ਉਹਨਾਂ ਦੀ ਯਾਦ ਦਿਲਾਉਂਦੇ ਹਨ ਕਿ ਸਾਡੇ ਪਿੰਡ ਵਿੱਚ ਹੜ੍ਹ ਆਇਆ ਸੀਗਾ ਇਸ ਤੋਂ ਇਲਾਵਾਂ ਕਈ ਤਰ੍ਹਾਂ ਦੇ ਸਟੈਂਪਸ ਵੀ ਮੇਰੇ ਦਾਦਾ ਜੀ ਦੇ ਸਮੇਂ ਵਰਤੇ ਜਾਂਦੇ ਸੀਗੇ ਉਹਨਾਂ ਦੀ ਸਟੈਂਪ ਕਚਿਹਰੀ ਦੇ ਸਟੈਂਪਸ ਕਈ ਤਰ੍ਹਾਂ ਦੇ ਮੈਂ ਸੰਭਾਲ ਕੇ ਰੱਖੇ ਹੋਏ ਹਨ ਇਸ ਤੋਂ ਇਲਾਵਾਂ ਸਿੱਕੇ ਸਿੱਕੇ ਵੀ ਅਠੱਨੀ ਚਵੱਨੀ ਪੈਸੇ ਪੈਸੇ ਮੈਂ ਇਕੱਠੇ ਕਰਕੇ ਰੱਖੇ ਹੋਏ ਹਨ ਉਹ ਮੇਰੇ ਦਾਦਾ ਜੀ ਦੱਸਦੇ ਸੀਗੇ ਕਿ ਸਿੱਕੇ ਪਹਿਲਾਂ ਇੱਕ ਰੁਪਏ ਦੇ ਸਿੱਕੇ ਪੱਚੀਂ ਪੈਸੇ ਵਿੱਚ ਕਈ ਤਰ ਰਾਸ਼ਨ ਮੰਗਾਲਿਆ ਜਾਂਦਾ ਸੀਗਾ ਕਾਫ ਪੂਰੇ ਘਰ ਦਾ ਰਾਸ਼ਨ ਮੰਗਾ ਲਿਆ ਜਾਂਦਾ ਸੀਗਾ ਪਰ ਹੁਣ ਇੱਕ ਰੁਪਏ ਨੂੰ ਕੋਈ ਨਹੀਂ ਪੁੱਛਦਾ ਹੁਣ ਇੱਕ ਰੁਪਏ ਦੀ ਕੋਈ ਵੀ ਮਹੱਤਤਾ ਨਹੀਂ ਹੈਗੀ